ਹਾਂ ਜਿੱਦਾਂ ਕਿ ਮੈਂ ਯੂ ਪੀ ਐਸ ਸੀ ਦੀ ਇੱਕ ਅਕੈਡਮੀ ਸ਼ੁਰੂ ਕਰਨਾ ਚਾਹੁੰਦੀ ਸੀ ਉਹਦੇ ਵਿੱਚ ਮੈਨੂੰ ਇੱਕ ਕਲਾਸ ਜਾਂ ਇੱਕ ਜਗ੍ਹਾ ਵਾਸਤੇ ਵੀ ਬਹੁਤ ਵੱਡੇ ਪੈ ਬਹੁਤ ਵੱਡੀ ਜਗ੍ਹਾ ਚਾਹੀਦੀ ਹੈ ਅਤੇ ਸਭ ਤੋਂ ਵੱਡੀ ਤਾਂ ਇਨਵੈਸਟਮੈਂਟ ਚਾਹੀਦੀ ਆ ਜੋ ਕਿ ਮੇਰੇ ਕਾਰੋਬਾਰ ਨੂੰ ਚਲਾ ਸਕੇ ਕਿਉਂਕਿ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਵਾਸਤੇ ਸਾਨੂੰ ਪੈਸਾ ਬਹੁਤ ਜ਼ਿਆਦਾ ਜ਼ਰੂਰੀ ਆ ਅਤੇ ਪੈਸਾ ਜਿੰਨਾ ਜ਼ਿਆਦਾ ਹੋਏਗਾ ਓਨਾ ਜ਼ਿਆਦਾ ਆਪਾਂ ਆਪਣਾ ਵਧੀਆ ਕਾਰੋਬਾਰ ਸ਼ੁਰੂ ਕਰ ਸਕਾਂਗੇ ਅਤੇ ਜਿੰਨਾ ਵਧੀਆ ਕਾਰੋਬਾਰ ਹੋਏਗਾ ਉਹ ਤੋਂ ਜ਼ਿਆਦਾ ਵਧੀਆ ਬੰਦੇ ਸਾਡੇ ਕੋਲ ਆਉਗੇ ਉਹਨਾਂ ਨੂੰ ਦੇਖ ਕੇ ਸਾਡੇ ਆਪਣੇ ਲੋਕੇਸ਼ਨ ਨੂੰ ਦੇਖ ਕੇ ਜਗ੍ਹਾ ਨੂੰ ਦੇਖ ਕੇ ਸੋਸਾਇਟੀ ਦੀ ਇਮੇਜ ਵੱਧਦੀ ਹੈ ਜਿਹਦੇ ਨਾਲ ਸਾਨੂੰ ਪਤਾ ਲੱਗਦਾ ਕਿ ਹਾਂ ਵੀ ਇਹ ਜਗ੍ਹਾ ਬਿਲਕੁਲ ਸਾਡੇ ਵਾਸਤੇ ਸੁਰੱਖਿਅਤ ਹੈ ਕਿ ਆਪਾਂ ਆਪਣਾ ਬੱਚਾ ਇੱਥੇ ਆਪਣਾ ਭੇਜ ਸਕਦੇ ਹਾਂ ਅਤੇ ਸਾਨੂੰ ਇਹ ਸਾਨੂੰ ਅੱਗੇ ਜਾ ਕੇ ਬਹੁਤ ਸਰਕਾਰ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਏਗਾ ਸਾਨੂੰ ਵੀ ਬਹੁਤ ਫਾਇਦਾ ਹੋਏਗਾ ਅਤੇ ਜਿਹੜੇ ਸਾਡੇ ਬੱਚੇ ਕੋਲ ਪੜ੍ਹਨ ਆਉਣਗੇ ਉਹ ਵੀ ਬਹੁਤ ਵਧੀਆ ਫਾਇਦੇ ਵਿੱਚ ਰਹਿਣਗੇ ਅਤੇ ਜਿਹਦੇ ਨਾਲ ਸਾਡੀ ਜੋ ਕਮਾਈ ਦਾ ਕਾਰਨ ਹੈ ਸਾਧਨ ਹੈ ਉਹ ਬਹੁਤ ਵਧੀਆ ਚੱਲੇਗਾ ਜਿਹਦੇ ਵਿੱਚ ਵੀ ਆਪਾਂ ਤਕਲੀਫ ਝੇਲ ਦੇਵਾਂਗੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਕਰ ਸਕਾਂਗੇ ਅਤੇ ਸਾਨੂੰ ਇਹ ਚਾਹੀਦਾ ਵਾ ਕਿ ਨਾ ਸਾਨੂੰ ਬਹੁਤ ਵਧੀਆ ਵੱਡੀ ਪੂੰਜੀ ਤਾਂ ਹਰ ਇੱਕ ਕੰਮ ਨੂੰ ਚਾਹੀਦੀ ਹੁੰਦੀ ਅਤੇ ਓਬਿਆ ਸਾਨੂੰ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਬੋਰਡ ਕੁਰਸੀਆਂ ਲਿਖਣ ਵਾਸਤੇ ਕਾਰ ਪੈਨ ਪੈਨਸਿਲ ਮਾਰਕਰ ਵਗੈਰਾ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੋਏਗੀ ਅਤੇ ਇਸ ਲਈ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਅੱਗੇ ਜਾ ਕੇ ਬਹੁਤ ਪੈਣ ਵਾਲੀ ਹੈ ਨਾ ਅਤੇ ਇਸ ਲਈ ਸਾਨੂੰ ਚਾਹੀਦਾ ਆ ਕਿ ਬਹੁਤ ਜ਼ਿਆਦਾ ਕੰਮ ਕਰੀਏ ਅੱਗੇ ਜਾ